ਹੈਲੋ ਗੁਡ ਮੋਰਨਿੰਗ ਸਰ ਸਰ ਮੈਂ ਵਿਨਾਸ਼ਰ ਸਿੰਘ ਬੋਲਦਾ ਛੇਵੀਂ ਕਲਾਸ ਦਾ ਟੀਚਰ ਸਰ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ ਜਿੱਦਾਂ ਕਿ ਕਲਾਸਾਂ 'ਚ ਕਈ ਪ੍ਰੋਬਲਮ ਇਸ਼ੂਸ਼ ਵਗੈਰਾ ਆ ਰਹੀਆਂ ਨੇ ਜਿੱਦਾਂ ਪੱਖੇ ਸਹੀ ਨਹੀਂ ਚੱਲਿਆ ਕਰਦੇ ਅਤੇ ਲਾਈਟਾਂ ਵਗੈਰਾ ਵੀ ਖ਼ਰਾਬ ਨੇ ਅਤੇ ਬੈਂਚ ਸਟੂਲ ਵਗੈਰਾ ਟੁੱਟੇ ਹੋਏ ਨੇ ਅਤੇ ਬੱਚੇ ਵੀ ਕਈ ਕਲਾਸਾਂ 'ਚ ਨਹੀਂ ਆ ਪਾ ਰਹੇ ਉਹਦੇ ਰਿਲੇਟਿਡ ਉਹਦੇ ਬਾਰੇ ਗੱਲ ਕਰਨੀ ਸੀ ਤੁਹਾਡੇ ਨਾਲ ਸਰ ਜਿੱਦਾਂ ਕਿ ਅਸੀਂ ਕਈ ਵਾਰੀ ਪੱਖੇ ਨਹੀਂ ਚੱਲਿਆ ਕਰਦੇ ਪੱਖੇ ਖ਼ਰਾਬ ਨੇ ਅਤੇ ਲਾਈਟਾਂ ਨਹੀਂ ਚੱਲਿਆ ਕਰਦੀਆਂ ਸਵਿੱਚ ਵਗੈਰਾ ਉਹਨਾਂ ਦੇ ਸਾਰੇ ਟੁੱਟੇ ਭੱਜੇ ਪਏ ਨੇ ਬੈਂਚ ਵਗੈਰਾ ਸੀਟਾਂ ਵਗੈਰਾ ਸਭ ਟੁੱਟੀਆਂ ਜਿਹੀਆਂ ਨੇ ਤੇ ਇਹਦਾ ਕੁਛ ਹੱਲ ਹੁਲ ਹੋ ਜੇ ਅਤੇ ਨਾਲੇ ਸਰ ਇੱਕ ਹੋਰ ਕੰਮ ਸੀ ਜਿੱਦਾਂ ਕਿ ਇੱਕ ਬਲੈਕ ਬੋਰਡ ਵੀ ਤੁਸੀਂ ਵੱਡਾ ਲਵਾ ਲਓ ਕਿਉਂਕਿ ਛੋਟੇ ਬਲੈਕ ਬੋਰਡ 'ਤੇ ਜ਼ਿਆਦਾ ਕੰਮ ਨਹੀਂ ਹੋ ਪਾਉਂਦਾ ਅਤੇ ਇਸ ਕਰਕੇ ਅੱਧਾ ਕੰਮ ਰਹਿ ਜਾਂਦਾ ਅਤੇ ਪੀਰੀਅਡ ਮੁੱਕ ਜਾਂਦਾ ਤਾਂ ਤੁਸੀਂ ਵੱਡਾ ਜਿਹਾ ਬਲੈਕ ਬੋਰਡ ਲਵਾ ਦਿਓ ਇੱਕ ਅਤੇ ਸਰ ਠੀਕ ਹੈ ਸਰ ਮੈਂ ਇੱਕ ਲਿਸਟ ਤਿਆਰ ਕਰ ਦਿੰਦਾ ਕੀ ਕਿ ਕੀ ਸਮੱਸਿਆਵਾਂ ਨੇ ਓਕੇ ਓਕੇ ਸਰ ਓਕੇ ਬਾਏ